ਸਾਡੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਅਤੇ ਉਹ ਪੱਛ ਅਤੇ ਉਹ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੀ ਹੈ ਸਾਡੇ ਸਾਡੇ ਸੱਭਿਆਚਾਰ ਵਿੱਚ ਲੋਕ ਲੋਕ ਪੱਛਮੀ ਪੱਛਮੀ ਦੇਸ਼ਾਂ ਦੀਆਂ ਬ ਸ ਦੇਸ਼ਾਂ ਦੇ ਉਸਨੂੰ ਅਜ਼ਮਾ ਰਹੀ ਹੈ ਪਰ ਸਾਨੂੰ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ਆਪਣੇ ਸੱਭਿਆਚਾਰ ਨਾਲ ਜੋ ਵੀ ਸਾਨੂੰ ਆਪਣੇ ਸੱਭਿਆਚਾਰ ਨੂੰ ਹਮੇਸ਼ਾ ਬਣਾਈ ਰੱਖਣਾ ਚਾਹੀਦਾ ਹੈ ਲੋਕ ਆਪਣੇ ਸੱਭਿਆਚਾਰ ਨੂੰ ਛੱਡ ਕੇ ਦੂਸਰਿਆਂ ਦੀਆਂ ਸੱਭਿਆਚਾਰ ਵਿੱਚ ਆ ਜਾਂਦੇ ਹਨ ਉਹ ਅਤੇ ਆਪਣੇ ਸੱਭਿਆਚਾਰ ਨੂੰ ਭੁੱਲ ਹੀ ਜਾਂਦੇ ਹਨ ਸਾਨੂੰ ਕਿਸੇ ਦੇ ਕਹ ਸਾਨੂੰ ਕਿਸੇ ਵੀ ਬਾਹਰਲੇ ਦੇਸ਼ਾਂ ਦਾ ਸਾਨੂੰ ਬਾਹਰਲੇ ਦੇਸ਼ਾਂ ਨਾਲ ਕਦੇ ਵੀ ਮੁਕਾਬਲਾ ਨਹੀਂ ਕਰਨਾ ਚਾਹੀਦਾ ਜੋ ਸਾਡਾ ਅਸਲੀ ਪਹਿਰਾਵਾ ਹੈ ਸਾਨੂੰ ਉਸ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਉਸ ਦੀ ਹੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਨਾਲ ਸਾਨੂੰ ਅ ਸਡ ਸਾਨੂੰ ਵਧੀਆ ਲੱਗਦਾ ਹੈ ਅਤੇ ਸਾਨੂੰ ਬਹੁਤ ਹੀ ਚੰਗਾ ਲੱਗਦਾ ਹੈ ਲੋਕ ਹੋਰ ਪੀੜ੍ਹੀ ਦੀਆਂ ਸੱਭਿਅਤਾਵਾਂ ਨੂੰ ਵਰ ਸੱਭਿਆਚਾਰ ਨੂੰ ਵਰਤ ਕੇ ਆਪਣੇ ਆਪਣੇ ਦੇਸ਼ ਦੀ ਹੀ ਪਕੜ ਵਿੱਚੋਂ ਬਾਹਰ ਜਾ ਰਹੇ ਹਨ